ਸਤਿ ਸ਼੍ਰੀ ਅਕਾਲ ਜੀ ਮੀਸ਼ੋ ਤੋਂ ਬੋਲਦੇ ਹੋ ਜੀ ਮੈਂ ਦੋ ਮਹੀਨੇ ਪਹਿਲਾਂ ਸਾੜੀ ਮੰਗਵਾਈ ਸੀ ਜਿਹੜੀ ਮੈਨੂੰ ਬਹੁਤ ਪਸੰਦ ਆਈ ਜਦੋਂ ਮੈਨੂੰ ਉਹ ਮਿਲੀ ਤਾਂ ਉਸਦੀ ਪੈਕਿੰਗ ਬਹੁਤ ਵਧੀਆ ਸੀ ਪੈਕਿੰਗ ਖੋਲ੍ਹੀ ਤਾਂ ਸਾੜੀ ਦਾ ਰੰਗ ਬਹੁਤ ਸੋਹਣਾ ਲੱਗਿਆ ਜੋ ਮੈਂ ਸਾੜੀ ਮੰਗਵਾਈ ਸੀ ਉਹੀ ਸਾੜੀ ਆਈ ਉਸ ਦਾ ਰੇਟ ਮਾਰਕਿਟ ਨਾਲੋਂ ਬਹੁਤ ਸਸਤਾ ਸੀ ਉਹ ਮੇਰੇ ਪਾਈ ਹੋਈ ਪੂਰੀ ਜੱਚ ਰਹੀ ਸੀ ਮੇਰੇ ਘਰਦਿਆਂ ਨੇ ਬਹੁਤ ਪਸੰਦ ਕੀਤੀ ਅੱਗੇ ਤੋਂ ਮੈਂ ਜੇ ਕੁਝ ਮੰਗਵਾਉਣਾ ਹੋਇਆ ਤਾਂ ਤੁਹਾਡੇ ਤੋਂ ਹੀ ਆਰਡਰ ਕਰਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ